ਮੈਮ ਸੰਜਨਾ ਗੱਲ ਕਰ ਰਹੇ ਹੋ ਤੁਸੀਂ ਹਾਂਜੀ ਮੈਮ ਮੈਂ ਟੇਸਟੀ ਗਰੁੱਪ ਯੂਟਿਊਬ ਚੈਨਲ ਤੋਂ ਗੱਲ ਕਰ ਰਹੀ ਹਾਂ ਅਤੇ ਹੋਰ ਅਤੇ ਇਹ ਨਾ ਫੂਡ ਫੂਡ ਬਲੋਗਰ 'ਤੇ ਅਸੀਂ ਆਹ ਕਰਨਾ ਸੀਗਾ ਹਾਂਜੀ ਮੈਮ ਕੁ ਕੁਝ ਤੁਸੀਂ ਦੱਸ ਸਕਦੇ ਹੋ ਵੀ ਕੋਈ ਆਪਣੇ ਖਾਣੇ ਵਾਲੀ ਚੀਜ਼ ਕਿਤੇ ਵੀ ਕਿੱਥੇ ਵਧੀਆ ਮਿਲਦੀ ਆ ਹਾਂਜੀ ਮੈਮ ਫਤਿਹਗੜ੍ਹ ਸਾਹਿਬ 'ਚ ਹਾਂਜੀ ਮੈਮ ਹਾਂਜੀ ਮੈਮ ਅੱਛਾ ਮੈਮ ਹਾਂਜੀ ਮੈਮ ਅੱਛਾ ਮੈਮ ਮੈਮ ਬ ਅੱਛਾ ਮੈਮ ਮੈਮ ਮਨਚੂਰੀਅਨ ਕਿੱਥੇ ਮਿਲੂ ਅੱਛਾ ਓਕੇ ਮੈਮ ਓਕੇ ਮੈਮ ਠੀਕ ਹੈ ਮੈਮ ਥੈਂਕ ਯੂ ਜੀ ਓਕੇ ਮੈਮ ਠੀਕ ਹੈ ਮੈਮ ਥੈਂਕ ਯੂ ਜੀ